ਹੈਲੋ ਸਤਿ ਸ਼੍ਰੀ ਅਕਾਲ ਜੀ ਕੁਲਦੀਪ ਸਿੰਘ ਬੋਲ ਰਹੇ ਹੋ ਹਾਂਜੀ ਕੱਲ ਅਸੀਂ ਏਅਰਪੋਰਟ ਜਾਣ ਲਈ ਓਲਾ ਐਪ ਤੋਂ ਕੈਬ ਬੁੱਕ ਕੀਤੀ ਸੀ ਗੱਡੀ ਨੰਬਰ ਹੈਗਾ ਅਠਾਈ ਅਠਾਈ ਹਾਂਜੀ ਸਰ ਅਸੀਂ ਇਸ ਲਈ ਕਾਲ ਕੀਤੀ ਸੀ ਕਿ ਕੱਲ ਤੁਸੀਂ ਨੌਂ ਵਜੇ ਸਾਡੇ ਕੋਲ ਸਮੇਂ ਸਿਰ ਪਹੁੰਚ ਜਾਵੋਗੇ ਤਾਂ ਜੋ ਸਾਡੀ ਫਲਾਈਟ ਨਾ ਮਿਸ ਹੋ ਸਕੇ ਹਾਂਜੀ ਸਰ ਬਹੁਤ ਬਹੁਤ ਧੰਨਵਾਦ ਜੀ ਨੌਂ ਵਜੇ ਤੁਸੀਂ ਸਾਡੇ ਕੋਲ ਟਾਈਮ ਸਿਰ ਪਹੁੰਚ ਜਿਓ ਓਕੇ ਸਰ